ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਸਤਾਰਾਂ ਦਸੰਬਰ ਉੱਨੀ ਸੌ ਤ੍ਰਿਆਸੀ ਛੇ ਅਕਤੂਬਰ ਉੱਨੀ ਸੌ ਪਚਾਸੀ ਸਤਾਈ ਅਗਸਤ ਉੱਨੀ ਸੌ ਬਿਆਸੀ ਇੱਕ ਜਨਵਰੀ ਦੋ ਹਜ਼ਾਰ ਤੇਰ੍ਹਾਂ